ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਹਾਂਜੀ ਠੀਕ ਹੈ ਠੀਕ ਹੈ ਜੀ ਇਸ ਤਰ੍ਹਾਂ ਜੀ ਤੁਸੀਂ ਆਪਣਾ ਮੈਂ ਤੁਹਾਨੂੰ ਇਹਦੇ 'ਚ ਪੂਰਾ ਆਪਣਾ ਸਹਿਯੋਗ ਦੇ ਸਕਦਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਗ੍ਹਾ ਹੈਗੀ ਹੈ ਸਰਹੰਦ ਦੇ ਵਿੱਚ ਇੱਥੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਾਇਆ ਗਿਆ ਸੀ ਉਹ ਤੁਹਾਨੂੰ ਦਿਖਾ ਦਿਆਂਗੇ ਠੀਕ ਹੈ ਜੀ ਅਤੇ ਉਹਦੇ ਨਾਲ ਹੀ ਗੁਰਦੁਆਰਾ ਠੰਢਾ ਬੁਰਜ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਨੂੰ ਉੱਥੇ ਆਪਣਾ ਰੱਖਿਆ ਕੈਦ ਕਰਕੇ ਰੱਖਿਆ ਸੀਗਾ ਵਜ਼ੀਰ ਖਾਨ ਨੇ ਉਹ ਉਹ ਉਹ ਉਹ ਚੀਜ਼ ਦਿਖਾ ਤੁਹਾਨੂੰ ਦਿਖਾ ਦਿਆਂਗੇ ਇਸ ਤੋਂ ਇਲਾਵਾ ਗੁਰਦੁਆਰਾ ਜੋਤੀ ਸਰੂਪ ਸਾਹਿਬ ਆ ਜਿਹੜੀ ਮੋਹਰਾਂ ਖੜੀਆਂ ਕਰਕੇ ਦੀਵਾਨ ਟੋਡਰ ਮੱਲ ਨੇ ਇਹ ਜਗ੍ਹਾ ਮੁੱਲ ਖਰੀਦੀ ਸੀਗੀ ਚੌਧਰੀ ਅੱਤੇ ਤੋਂ ਖਰੀਦੀ ਸੀ ਇਹ ਇਹ ਵੀ ਤੁਹਾਨੂੰ ਦਿਖਾ ਦਿਆਂਗੇ ਇਸ ਤੋਂ ਇਲਾਵਾ ਮ ਮਤਲਬ ਕਿ ਜਿਹੜਾ ਹੈਗਾ ਤੁਹਾਡਾ ਕੀ ਕਹਿੰਦੇ ਹੁੰਦੇ ਹੈਗੇ ਹੈ ਇਹ ਜਿਹੜਾ ਮੋਤੀ ਰਾਮ ਮੋਤੀ ਰਾਮ ਮਹਿਰਾ ਹੈਗਾ ਉਹ ਜਗ੍ਹਾ ਵੀ ਉੱਥੇ ਜਿਨ੍ਹਾਂ ਨੇ ਆਪਣਾ ਦੁੱਧ ਪਲਾਇ ਪਿਲਾਇਆ ਸੀ ਆਪਣਾ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਨੂੰ ਉਹ ਗੁਰਦੁਆਰਾ ਸਾਹਿਬ ਵੀ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਹੈ ਜੀ ਅਤੇ ਬਾਕੀ ਹੋਰ ਵੀ ਦੇਖ ਲਵਾਂਗੇ ਜਿਹੜਾ ਸਰਹੰਦ ਦੇ ਜਿੱਥੇ ਜਿੱਥੇ ਵੀ ਜਿੱਥੇ ਜਿੱਥੇ ਵੀ ਮਤਲਬ ਕਿ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਉੱਥੇ ਉੱਥੇ ਤੁਹਾਨੂੰ ਉਹ ਸਾਰੀਆਂ ਤੁਹਾਨੂੰ ਦਿਖਾ ਦਿਆਂਗੇ ਜੀ ਜੋ ਜਗ੍ਹਾ ਜਿਹੜੀਆਂ ਜਿਹੜੀਆਂ ਇਤਿਹਾਸ ਨਾਲ ਸੰਬੰਧਿਤ ਹੈਗੀਆਂ ਇਸ ਅ ਆਪਣਾ ਸਾਕੇ ਨਾਲ ਸੰਬੰਧਿਤ ਹੈਗੀਆਂ ਹਾਂਜੀ ਹਾਂਜੀ ਸੇਵਾ ਕੋਈ ਗੱਲ ਨਹੀਂ ਤੁਸੀਂ ਸੇਵਾ ਦਾ ਤਾਂ ਇਸ ਤਰ੍ਹਾਂ ਹੈਗਾ ਬਈ ਤੁਸੀਂ ਤੁਹਾਡਾ ਜੇ ਸਾਡਾ ਕੰਮ ਵਧੀਆ ਤੁਹਾਨੂੰ ਲੱਗਿਆ ਤਾਂ ਉਸ ਹਿਸਾਬ ਨਾਲ ਉਹ ਤਾਂ ਆਪਾਂ ਚੱਲੋ ਮੌਕੇ 'ਤੇ ਡਿਸਾਈਡ ਕਰ ਲਵਾਂਗੇ ਤੁਹਾਡਾ ਜੋ ਵੀ ਹੋਇਆ ਨਾ ਹਾਂ ਉਹ ਇੰਨਾ ਕੁ ਹੀ ਆ ਵੀ ਆਪਣਾ ਆਪਾਂ ਕੰਮ ਦੇਖ ਕੇ ਫਿਰ ਤੁਸੀਂ ਉਹ ਹਿਸਾਬ ਨਾਲ ਤੁਸੀਂ ਸਾਨੂੰ ਕਰ ਦਿਓ ਜੋ ਵੀ ਬਣਿਆ ਤੁਹਾਡਾ ਹਾਂ ਹਾਂ ਹਾਂ ਠੀਕ ਹੈ ਜੀ ਕੋਈ ਇਸ ਗੱਲ ਨਹੀਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਹਾਂ ਵਾਹਿਗੁਰੂ ਜੀ ਕਾ ਖਾਲ